ਹੈਲੋ ਨਮਸਕਾਰ ਜੀ ਮੈਂ ਨਾ ਯੋਗੇ ਦੇ ਬਾਰੇ ਦੱਸਦੇ ਪਏ ਕਿ ਯੋਗੇ ਦਾ ਕੀ ਬੈਨੀਫਿਟ ਹੈ ਯੋਗੇ ਦੇ ਬਹੁਤ ਜ਼ਿਆਦਾ ਬੈਨੀਫਿਟ ਹੈ ਇਹ ਸਰੀਰ 'ਤੇ ਦੇ ਲਈ ਇੱਕ ਖ਼ਾਸ ਮਹੱਤਵ ਰੱਖਦਾ ਹੈ ਯੋਗਾ ਕਰਨਾ ਸਰੀਰ ਦੇ ਲਈ ਬਹੁਤ ਜ਼ਿਆਦਾ ਖ਼ਾਸ ਜ਼ਰੂਰੀ ਹੈ ਕਿਉਂਕਿ ਅਗਰ ਅਸੀਂ ਸਵੇਰੇ ਉੱਠ ਕੇ ਯੋਗਾ ਕਰਦੇ ਹਾਂ ਤਾਂ ਸਾਡੀ ਪਾਚਕ ਸ਼ਕਤੀ ਠੀਕ ਹੁੰਦੀ ਹੈ ਸਾਡੇ ਸਰੀਰ ਦੇ ਸੈੱਲ ਟੁੱਟਦੇ ਭਿਰਦੇ ਹਨ ਅਤੇ ਉਹਨਾਂ ਦੇ ਨਾਲ ਸਾਡੇ ਸਰੀਰ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਨੰਬਰ ਦੋ ਮੇਰੇ ਯੋਗਾ ਕਰਨ ਦੇ ਨਾਲ ਮੇਰੀਆਂ ਲੱਤਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੇ ਸੀ ਮੇਰੀਆਂ ਲੱਤਾਂ ਦੀ ਦੂਰ ਹੋ ਗਈ ਹੱਡੀਆਂ ਦੀ ਕੜ ਕੜ ਦੀ ਆਵਾਜ਼ ਆਉਂਦੀ ਸੀ ਜਦ ਕਿ ਇੱਕ ਮੈਂ ਜੋਗਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੀਆਂ ਹੱਡੀਆਂ ਦੀ ਆਵਾਜ਼ ਵੀ ਖਤਮ ਹੋ ਗਈ ਇਸ ਕਰਕੇ ਯੋਗਾ ਕਰਨਾ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ ਯੋਗੇ ਦੇ ਅਭਿਆਸ ਕਰਨ ਦੇ ਨਾਲ ਮੈਨੂੰ ਵੱਧ ਤੋਂ ਵੱਧ ਫ਼ਾਇਦਾ ਹੋਇਆ ਹੈ ਕਿਉਂਕਿ ਜੋਗਾ ਕਰਦੀ ਅਤੇ ਉਹਦੇ ਨਾਲ ਮੇਰੇ ਸਰੀਰ ਦੀ ਤੰਦਰੁਸਤੀ ਅਤੇ ਅਤੇ ਮੈਨੂੰ ਚੱਲਣ ਦੇ ਵਿੱਚ ਵੀ ਬਹੁਤ ਜ਼ਿਆਦਾ ਮਦਦ ਮਿਲੀ ਹੈ ਇਸ ਕਰਕੇ ਯੋਗੇ ਦਾ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲਿਆ ਹੈਗਾ ਹੈ